ਹਾਂਜੀ ਹਸਪਤਾਲਾਂ ਦੇ ਮਾਮਲੇ ਵਿੱਚ ਬਹੁਤ ਹੀ ਮਾੜੇ ਅਨੁਭਵ ਅਕਸਰ ਦੇਖੇ ਜਾ ਸਕਦੇ ਹਨ ਕਿਉਂਕਿ ਮੈਂ ਇੱਕ ਹੈਲਥ ਡਿਪਾਰਟਮੈਂਟ ਦੇ ਵਿੱਚ ਕੰਮ ਕਰਦੇ ਹੋਣ ਦੇ ਬਾਵਜੂਦ ਮੈਨੂੰ ਇੱਥੇ ਦੇਖਣ ਨੂੰ ਅਕਸਰ ਮਿਲਿਆ ਜਾਂਦਾ ਆ ਕਿ ਜਿਹੜੇ ਕਿ ਅੱਜ ਕੱਲ੍ਹ ਦੀ ਮਹਿੰਗਾਈ ਲੈ ਲਓ ਤੁਸੀਂ ਕਿ ਜਿਹੜਾ ਆਮ ਬੰਦਾ ਹੈਗਾ ਉਹ ਆਪਣੀ ਸਿਹਤ ਵੀ ਨਹੀਂ ਅਫੋਰਡ ਕਰ ਸਕਦਾ ਹੈ ਨਾ ਕਿਉਂਕਿ ਅੱਜ ਕੱਲ੍ਹ ਦੀਆਂ ਬਿਮਾਰੀਆਂ ਨਵੀਆਂ ਨਵੀਆਂ ਬਿਮਾਰੀਆਂ ਆ ਗਈਆਂ ਹਨ ਅਤੇ ਉਸ ਦੇ ਇਲਾਜ ਉਨੇ ਹੀ ਮਹਿੰਗੇ ਹਨ ਤੇ ਹੁਣ ਤੁਸੀਂ ਆਮ ਕਿਸੇ ਹੋਸਪਿਟਲ 'ਚ ਚਲੇ ਜਾਓ ਇੱਕ ਜਿਹੜਾ ਮਾੜਾ ਮਿਡਲ ਕਲਾਸ ਬੰਦਾ ਹੋਏਗਾ ਉਹ ਪਹਿਲੇ ਤਾਂ ਇੱਕ ਲੰਬੀ ਸਾਰੀ ਕਤਾਰ ਦੇ ਵਿੱਚ ਲੱਗਿਆ ਹੋਏਗਾ ਪਹਿਲੇ ਉਸ ਤੋਂ ਪੈਸੇ ਹੀ ਲਿਮਿਟਡ ਹੁੰਦੇ ਹਨ ਠੀਕ ਆ ਕਿ ਉਹ ਆਪਣਾ ਜਿਹੜਾ ਢੰਗ ਤਰੀਕੇ ਨਾਲ ਪੂਰਾ ਇਲਾਜ ਕਰਾ ਸਕੇ ਉੱਪਰੋਂ ਦੀ ਕਿ ਅਕਸਰ ਦੇਖਿਆ ਜਾਂਦਾ ਹੈ ਕਿ ਸਰਕਾਰੀ ਹੋਸਪੀਟਲਾਂ ਦੇ ਵਿੱਚ ਕਿ ਕਈ ਤਰ੍ਹਾਂ ਜਿਹੜਾ ਆਮ ਬੰਦਾ ਹੈ ਉਹ ਤਾਂ ਸਭ ਤੋਂ ਪਹਿਲਾਂ ਪ੍ਰੈਫਰ ਕਰੂਗਾ ਕਿ ਮੈਂ ਸਰਕਾਰੀ ਹਸਪਤਾਲ ਦੇ ਵਿੱਚ ਜਾਵਾਂ ਠੀਕ ਆ ਉੱਥੇ ਅਕਸਰ ਹੁੰਦਾ ਹੈ ਕਿ ਕਈ ਨਾ ਕਈ ਕੋਈ ਸਾਧਨ ਨਹੀਂ ਹੁੰਦਾ ਇੰਨਾ ਕੁ ਮਾੜੇ ਘਰੋਂ ਵੀ ਲੋਕ ਹੁੰਦੇ ਹਨ ਕਿ ਉਹ ਆਪਣਾ ਜਿਹੜਾ ਕਿਰਾਇਆ ਤੱਕ ਨਹੀਂ ਦੇ ਸਕਦੇ ਉੱਥੇ ਹੈ ਨਾ ਜਾ ਸਕਦੇ ਅਤੇ ਉ ਉਸ ਤੋਂ ਬਾਅਦ ਕਿ ਕਈ ਹੋਸ ਸ ਸਰਕਾਰੀ ਚੀਜ਼ਾਂ ਹੋਸਪਿਟਲਾਂ ਵਿੱਚ ਕਈ ਚੀਜ਼ਾਂ ਇਹੋ ਜਿਹੀਆਂ ਹਨ ਕਿ ਜਿਹੜੀਆਂ ਨਹੀਂ ਉਪਲੱਬਧ ਹੁੰਦੀਆਂ ਉਹ ਸਿਰਫ ਪ੍ਰਾਈਵੇਟ ਹਸਪਤਾਲ ਵਿੱਚ ਹੀ ਮਿਲਦੀਆਂ ਹਨ ਹੈ ਨਾ ਜਾਂ ਉਹ ਸਰਕਾਰੀ 'ਚ ਮਿਲਦੀਆਂ ਹਨ ਪਰ ਉਹਨਾਂ 'ਤੇ ਹੀ ਜ਼ਿਆਦਾ ਖਰਚਾ ਆਉਂਦਾ ਆ ਇਸ ਕਰਕੇ ਇਹੋ ਜਿਹੇ ਮਾੜੇ ਅਨੁਭਵ ਅਕਸਰ ਹੀ ਦੇਖਣ ਨੂੰ ਮਿਲਦੇ ਹਨ